ਹਾਂਜੀ ਸਤਿ ਸ਼੍ਰੀ ਅਕਾਲ ਜੀ ਪੀਜ਼ਾ ਹੱਟ ਤੋਂ ਬੋਲਦੇ ਹੋ ਹਾਂਜੀ ਮੇਰਾ ਨਾਮ ਕਮਲ ਹੈ ਮੈਂ ਗੁਰੂ ਨਾਨਕ ਨਗਰ ਗਲੀ ਨੰਬਰ ਚੌਦ੍ਹਾਂ ਤੋਂ ਬੋਲਦੀ ਹਾਂ ਹਾਂਜੀ ਮੈਂ ਇੱਕ ਔਨਲਾਈਨ ਔਰਡਰ ਬੁੱਕ ਕਰਵਾਉਣਾ ਏ ਹਾਂਜੀ ਦੋ ਪੀਜ਼ਾ ਔਰਡਰ ਬੁੱਕ ਕਰਵਾਉਣੇ ਆ ਜੀ ਜੀ ਹਾਂਜੀ ਦੋਨਾਂ ਦਾ ਸਾਇਜ਼ ਲਾਰਜ ਰੱਖ ਦਿਓ ਜੀ ਹਾਂਜੀ ਇੱਕ ਦੇ ਵਿੱਚ ਤੁਸੀਂ ਹਰੀਆਂ ਸਬਜ਼ੀਆਂ ਜਿੰਨੀਆਂ ਤੁਹਾਡੇ ਕੋਲ ਮੌਜੂਦ ਨੇ ਉਹਨਾਂ ਦੀ ਟੋਪਿੰਗ ਕਰ ਦਿਓ ਅਤੇ ਇੱਕ ਦੇ ਵਿੱਚ ਤੁਸੀਂ ਓਨਲੀ ਪਨੀਰ ਦੀ ਟੋਪਿੰਗ ਕਰ ਦਿਓ ਜੀ ਹਾਂਜੀ ਦੋਨਾਂ ਦੇ ਵਿੱਚ ਜਿਹੜੇ ਚੀਜ਼ ਹੈ ਉਹ ਐਕਸਟਰਾ ਹੀ ਰੱਖਿਓ ਹਾਂਜੀ ਅਤੇ ਸਰ ਮੇਰਾ ਬਿੱਲ ਕਿੰਨਾਂ ਬਣਿਆ ਜੀ ਹਾਂਜੀ ਇਹਦੇ ਵਿੱਚ ਤੁਸੀਂ ਮੈਨੂੰ ਕੋਈ ਡਿਸਕਾਊਂਟ ਦੇ ਰਹੇ ਹੋ ਸਰ ਠੀਕ ਹੈ ਜੀ ਅੱਜ ਮੈਂ ਤੁਹਾਡਾ ਔਨਲਾਈਨ ਪੇਜ ਵਿਜਿਟ ਕਰ ਰਹੀ ਹਾਂ ਅਤੇ ਤੁਸੀਂ ਅੱਜ ਦੇ ਦਿਨ ਜੋ ਔਰਡਰ ਕਰਦੇ ਆ ਔਨਲਾਈਨ ਉਹਨੂੰ ਤੁਸੀਂ ਪੰਜਾਹ ਪ੍ਰਸੈਂਟ ਡਿਸਕਾਊਂਟ ਦੇ ਰਹੇ ਹੋ ਹਾਂਜੀ ਅੱਜ ਹੀ ਮੈਨੂੰ ਔਰਡਰ ਚਾਹੀਦਾ ਜੀ ਸਤਾਰ੍ਹਾਂ ਤਰੀਕ ਨੂੰ ਹਾਂਜੀ ਚਲੋ ਠੀਕ ਹੈ ਜੀ ਤੁਸੀਂ ਦੋ ਕੁ ਵਜੇ ਤੱਕ ਤੁਸੀਂ ਮੈਨੂੰ ਡਿਲੀਵਰ ਕਰ ਦਿਓ ਜੀ ਹਾਂਜੀ ਤਕਰੀਬਨ ਦੋ ਕੁ ਵਜੇ ਤੱਕ ਹਾਂਜੀ ਹਾਂਜੀ ਪੇ ਮੈਂ ਕੈਸ਼ ਔਨ ਡਿਲੀਵਰੀ ਕਰਾਂਗੀ ਜੀ ਠੀਕ ਹੈ ਜੀ ਧੰਨਵਾਦ ਜੀ ਮੈਂ ਆਪਣੇ ਔਡਰ ਦਾ ਵੇਟ ਕਰ ਰਹੀ ਹਾਂ